ਮੈਨੂੰ ਲਿਖਣ ਸਮੇਂ ਬਹੁਤ ਸਾਰੇ ਵਿਚਾਰ ਕੁਦਰਤੀ ਆ ਜਾਂਦੇ ਹਨ ਆ ਜਾਂਦੇ ਹਨ ਅਤੇ ਮੈਂ ਉਹਨਾਂ ਨੂੰ ਇੱਕ ਕਾਪੀ ਵਿੱਚ ਲਿਖ ਲੈਂਦੀ ਹਾਂ ਤਾਂ ਕਿ ਜਦੋਂ ਵੀ ਮੈਂ ਕੁੱਛ ਲਿਖਣ ਬੈਠਾ ਤਾਂ ਮੇਰੇ ਕੋਲ ਪਹਿਲਾਂ ਹੀ ਪਹਿਲਾਂ ਹੀ ਉਸ ਬਾਰੇ ਜਾਣਕਾਰੀ ਮੌਜੂਦ ਹੋਵੇ ਇਸ ਨਾਲ ਮੇਰੀ ਲਿਖਾਈ ਬਹੁਤ ਵਧੀਆ ਹੋ ਜਾਂਦੀ ਹੈ ਅਤੇ ਸਾਨੂੰ ਹਮੇਸ਼ਾਂ ਹੀ ਆਪਣੇ ਦਿਮਾਗ ਵਿੱਚ ਚਲਦੀਆਂ ਗੱਲਾਂ ਜੋ ਅਸੀਂ ਆਪਣੀ ਕਿਤਾਬ ਵਿੱਚ ਲਿਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਹੀ ਇੱਕ ਕਾਪੀ ਵਿੱਚ ਲਿਖ ਲੈਣਾ ਚਾਹੀਦਾ ਹੈ ਤਾਂ ਕਿ ਜੇ ਅਸੀਂ ਭੁੱਲ ਵੀ ਜਾਈਏ ਤਾਂ ਸਾਨੂੰ ਯਾਦ ਰਹੇ ਕਿ ਅਸੀਂ ਕਿਸ ਵਿਚਾਰ ਉੱਤੇ ਸੋਚ ਰਹੇ ਹਾਂ ਜਾਂ ਸਾਨੂੰ ਕਿਸ ਚੀਜ਼ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਲਿਖਣ ਸਮੇਂ ਇਹ ਚੀਜ਼ ਸਾਡੀ ਲਿਖਾਈ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀ ਹੈ ਅਤੇ ਅਸੀਂ ਹੋਰ ਸ ਸਮਾਜ ਨੂੰ ਸਮਝਦੇ ਹਨ ਅਤੇ ਆਪਣੇ ਵਿਚਾਰਾਂ ਨੂੰ ਹੋਰ ਵਧੀਆ ਕਰਕੇ ਲਿਖਦੇ ਹਨ